ਹੈਲੋ ਤੁਸੀਂ ਕਰਮਜੀਤ ਐੱਮ ਸੀ ਬੋਲਦੇ ਹੋ ਜੀ ਸਤਿ ਸ਼੍ਰੀ ਅਕਾਲ ਮਾਤਾ ਜੀ ਹਾਂਜੀ ਮਾਤਾ ਜੀ ਮੈਂ ਵਾਰਡ ਨੰਬਰ ਪੰਜ ਤੋਂ ਬੋਲਦਾ ਜੀ ਹੰਢਾਇਆ ਪਿੰਡ ਤੋਂ ਜੀ ਹਾਂਜੀ ਅਤੇ ਮੈਂ ਮੈਂ ਤੁਹਾਨੂੰ ਦੇਖਿਆ ਤੁਸੀਂ ਚਾਰ ਨੰਬਰ ਵਾਰਡ ਦੇ ਵਿੱਚ ਵਧੀਆ ਕੰਮ ਕਰਵਾ ਰਹੇ ਹੋ ਜੀ ਹਾਂਜੀ ਸੀਵਰੇਜ ਪਵਾ ਰਹੇ ਹੋ ਉੱਧਰ ਅਤੇ ਮੈਂ ਵਾਰਡ ਨੰਬਰ ਪੰਜ ਦੇ ਵਿੱਚੋਂ ਬੋਲਦਾ ਹਾਂ ਜੀ ਵਾ ਵਾਰਡ ਨੰਬਰ ਪੰਜ ਦੀਆਂ ਗਲੀਆਂ ਦੀ ਬਹੁਤ ਬੁਰੀ ਹਾਲਤ ਹੈ ਜੀ ਹਾਂਜੀ ਮੀਂਹ ਵਿਚ ਇਹਨਾਂ ਵਿੱਚ ਪਾਣੀ ਖੜ੍ਹ ਜਾਂਦਾ ਹੈ ਜੀ ਲੰਘਣ ਲਈ ਰਾਸਤਾ ਨਹੀਂ ਹੁੰਦਾ ਜੀ ਹਾਂਜੀ ਇੱਥੇ ਚਿੱਕੜ ਹੋ ਜਾਂਦਾ ਤੋ ਬੱਚਿਆਂ ਨੂੰ ਬਿਮਾਰੀਆਂ ਲੱਗ ਰਹੀਆਂ ਹਨ ਜੀ ਹਾਂਜੀ ਅਤੇ ਮੈਂ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਤੁਸੀਂ ਵਾਰਡ ਨੰਬਰ ਪੰਜ ਦਾ ਚਾਰ ਦਾ ਕੰਮ ਕਰਵਾ ਰਹੇ ਹੈ ਉਸ ਤਰ੍ਹਾਂ ਤੁਸੀਂ ਸਾਡੇ ਵਾਰਡ ਨੰਬਰ ਪੰਜ ਦਾ ਵੀ ਕੰਮ ਕਰਵਾਇਆ ਜਾਵੇ ਹਾਂਜੀ ਹਾਂਜੀ ਹਾਂਜੀ ਮਾਤਾ ਜੀ ਹਾਂਜੀ ਹਾਂਜੀ ਹਾਂਜੀ ਹਾਂ ਹਾਂਜੀ ਮਾਤਾ ਜੀ ਹਾਂ ਬਹੁਤ ਬੁਰੀ ਹਾਲਤ ਆ ਹਾਂਜੀ ਹਾਂਜੀ ਹਾਂ ਬਸ ਹਾਂਜੀ ਮੈਂ ਜੀ ਤੁਹਾਨੂੰ ਧਿਆਨ ਦੇ ਵਿੱਚ ਦੇਣ ਦੇ ਲਈ ਮੈਂ ਤੁਹਾਨੂੰ ਕੌਲ ਕੀਤੀ ਸੀ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅਗਲੀ ਅਗਲੀ ਵਾਰ ਵੀ ਵੋਟਾਂ ਦੇ ਵਿੱਚ ਅਸੀਂ ਤੁਹਾਨੂੰ ਹੀ ਐੱਮ ਸੀ ਚੁਣਨਾ ਚਾਹੁੰਦੇ ਹਾਂ ਜੀ ਹਾਂਜੀ ਹਾਂਜੀ ਹਾਂਜੀ ਮੈਂ ਇਹ ਹੀ ਚਾਹੁੰਦਾ ਸੀ ਵੀ ਚੱਲ ਤੁਹਾਡੇ ਇੱਕ ਵਾਰ ਧਿਆਨ ਦੇ ਵਿੱਚ ਕਰਵਾ ਦਿੱਤਾ ਜਾਵੇ ਕਿਉਂਕਿ ਜੀ ਤੁਸੀਂ ਹਾਂਜੀ ਹਾਂਜੀ ਹਾਂ ਉਹ ਤਾਂ ਹੈ ਜੀ ਹਾਂਜੀ ਹਾਂ ਬਸ ਠੀਕ ਹੈ ਜੀ ਹਾਂਜੀ ਆਪ ਹਾਂ ਹਾਂਜੀ ਧੰਨਵਾਦ ਜੀ ਹਾਂਜੀ ਹਾਂਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਓ